ਜਦੋਂ ਮੈਂ ਪੇਂਟਿੰਗ ਕਰਨੀ ਸ਼ੁਰੂ ਕੀਤੀ ਸੀ ਤਾਂ ਮੈਂ ਯੂਟੀਊਬ ਦੀ ਮਦਦ ਲਿੱਤੀ ਸੀ ਕਿਉਂਕਿ ਮੈਨੂੰ ਉਦੋਂ ਪੇਂਟਿੰਗ ਕਰਨੀ ਨਹੀਂ ਆਉਂਦੀ ਸੀ ਪਰ ਮੈਨੂੰ ਪੇਂਟਿੰਗ ਕਰਨ ਦਾ ਸ਼ੌਂਕ ਸੀਗਾ ਇਸ ਲਈ ਮੈਂ ਯੂਟੀਊਬ ਤੋਂ ਵੀਡੀਓਜ਼ ਵਗੈਰਾ ਪਿਕਚਰ ਦੇਖ ਕੇ ਪੇਂਟਿੰਗ ਕਰਦੀ ਹੁੰਦੀ ਸੀ ਅਤੇ ਮੇਰੇ ਜਾਂ ਮੈਂ ਆਪਣੇ ਚਾਚੇ ਤਾਏ ਦੇ ਮੁੰਡੇ ਤੋਂ ਵੀ ਮਦਦ ਲੈਂਦੀ ਹੁੰਦੀ ਸੀ ਕਿਉਂਕਿ ਉਹ ਐਕਸ ਪੇਂਟਿੰਗ ਵਿੱਚ ਐਕ ਐਕਸਪਰਟ ਨੇ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੰਪੀਟੀਸ਼ਨਾਂ ਵਿੱਚ ਪਾਰਟੀਸਪੇਟ ਕੀਤਾ ਹੈ ਅਤੇ ਬਹੁਤ ਜ਼ਿਆਦਾ ਮੈਡਲ ਅਤੇ ਟਰੋਫੀਜ ਜਿੱਤੇ ਹਨ ਅਤੇ ਉਹਨਾਂ ਨੂੰ ਪੇਂਟਿੰਗ ਦਾ ਬਹੁਤ ਹੀ ਤਜਰਬਾ ਹੈ ਇਸ ਲਈ ਮੈਂ ਉਹਨਾਂ ਦੀ ਮਦਦ ਨਾਲ ਕਈ ਵਾਰ ਉਹਨਾਂ ਤੋਂ ਟਿਪਸ ਵਗੈਰਾ ਲੈ ਕੇ ਪੇਂਟਿੰਗ ਬਣਾਉਂਦੀ ਹੁੰਦੀ ਸੀ ਅਤੇ ਉਹ ਵੀ ਮੇਰੀ ਮਦਦ ਕਰ ਦਿੰਦੇ ਹੁੰਦੇ ਸਨ ਅਤੇ ਹੁਣ ਮੈਨੂੰ ਹੌਲੀ ਹੌਲੀ ਪੇਂਟਿੰਗ ਕਰਨੀ ਆ ਗਈ ਹੈ ਅਤੇ ਮੈਨੂੰ ਪੇਂਟਿੰਗ ਵਿੱਚ ਬਹੁਤ ਹੀ ਐਕਸਪੀਰੀਅਸ ਹੋ ਗਿਆ ਅਤੇ ਮੈਂ ਹੁਣ ਪੇਂਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਮੈਂ ਕਿਸੇ ਵੀ ਰੈਂਡਮ ਪਰਸਨ ਜਾਂ ਆਪਣੇ ਫਰੈਂਡਸ ਵਗੈਰਾ ਕਿਸੇ ਦੀ ਵੀ ਪੇਂਟਿੰਗ ਬਣਾ ਕੇ ਦੇ ਸਕਦੀ ਹਾਂ ਅਤੇ ਮੈਨੂੰ ਮੈਂ ਜਦੋਂ ਕਿਤੇ ਵੀ ਘੁੰਮਣ ਵਗੈਰਾ ਜਾਵਾਂ ਤਾਂ ਮੈਨੂੰ ਉੱਥੋਂ ਦਾ ਵਿਊ ਵਧੀਆ ਲੱਗਦਾ ਤਾਂ ਮੈਂ ਉੱਥੇ ਪੇਂਟਿੰਗ ਕਰਨੀ ਲਈ ਸ਼ੁਰੂ ਦਿੰਦਾ ਜਦੋਂ ਵੀ ਮੈਂ ਫਰੀ ਟਾਈਮ ਹੋਵਾਂ ਜਾਂ ਮੈਂ ਬੋਰ ਹੋ ਰਹੀ ਹੋਵਾਂ ਤਾਂ ਮੈਨੂੰ ਪੇਂਟਿੰਗ ਕਰਨੀ ਪਸੰਦ ਹੈ ਅਤੇ ਮੈਂ ਪੇਂਟਿੰਗ ਕਰਨੀ ਸ਼ੁਰੂ ਕਰ ਦਿੰਦੀ ਹਾਂ ਅਤੇ ਜਿਸ ਕਲਰ ਸਕੈਚਾਂ ਨਾਲ ਮੈਂ ਪੇਂਟਿੰਗ ਕਰਦੀ ਹਾਂ ਅਤੇ ਉਹ ਮੈਂ ਲੋਕਲ ਮਾਰਕੀਟ ਤੋਂ ਹੀ ਖ਼ਰੀਦਦੀ ਹਾਂ ਕਈ ਵਾਰ ਉਹ ਮੈਨੂੰ ਮਹਿੰਗੇ ਪੈ ਜਾਂਦੇ ਹਨ ਪਰ ਕਈ ਵਾਰ ਮੈਨੂੰ ਉਹ ਔਨਲਾਈਨ ਸ਼ੋਪਿੰਗ ਤੋਂ ਸਸਤੇ ਪੈ ਜਾਂਦੇ ਨੇ ਡਿਸਕਾਊਂਟ 'ਤੇ ਮਿਲ ਜਾਂਦੇ ਹਨ ਅਤੇ ਮੈਂ ਅ ਜ਼ਿਆਦਾਤਰ ਪੇਂਟਿੰਗ ਵਾਟਰ ਕਲਰ ਨਾਲ ਹੀ ਕਰਨਾ ਪਸੰਦ ਕਰਦੀ ਹਾਂ ਜਾਂ ਪੈਂਸਲ ਕਲਰ ਨਾਲ ਅਤੇ ਮੈਂ ਆਪਣੇ ਕਲਰ ਦਾ ਬ੍ਰੈਂਡ